ਹਾਂਜੀ ਮੈਂ ਇੱਕ ਗੇਮਿੰਗ ਕੰਸੋਲ ਦੀ ਸੁਪਰਤਗੀ ਨਾਲ ਵੀ ਸੁਪਰਦਗੀ ਨਾਲ ਬੇਸਬਰੀ ਦਾ ਉਡੀਕ ਕਰ ਰਹੀ ਸੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ ਉਹ ਮੇਰਾ ਮਤਲਬ ਅ ਆਇਆ ਨਹੀਂ ਸੀ ਔਡਰ ਜੋ ਮੈਂ ਔਨਲਾਈਨ ਔਡਰ ਕੀਤਾ ਸੀ ਅਤੇ ਮਤਲਬ ਮੈਂ ਉਸ ਬਾਰੇ ਪੁੱਛ ਗਿੱਛ ਕਰਨਾ ਚਾਹੁੰਦੀ ਹਾਂ ਕਿ ਅ ਮੈਂ ਇਸ ਐਡਰੈਸ 'ਤੇ ਔਡਰ ਕੀਤਾ ਸੀ ਮੈਂ ਗ ਗਿੱਦੜਵਾਹਾ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਮੁਕਤਸਰ ਅਡਿਸਟਰਿਕਟ ਹੈ ਅਤੇ ਮਾਰਕ ਫੈਡ ਦੇ ਰਹਿਣ ਵਾਲੀ ਹਾਂ ਮੈਂ ਜਦੋਂ ਔਡਰ ਕੀਤਾ ਸੀ ਤਾਂ ਮੈਂ ਮਤਲਬ ਲੋਕੇਸ਼ਨ ਵੀ ਪਾਈ ਸੀ ਅਤੇ ਫੋਨ ਨੰਬਰ ਸਭ ਕੁਝ ਟਾਈਪ ਕੀਤਾ ਹੋਇਆ ਸੀ ਲੇਕਿਨ ਮੇਰਾ ਔਡਰ ਪਹੁੰਚਿਆ ਨਹੀਂ ਮੈਂ ਇਹ ਹੀ ਪੁੱਛਣਾ ਚਾਹੁੰਦੀ ਹਾਂ ਕਿ ਮਤਲਬ ਮੇਰਾ ਔਡਰ ਕਿਉਂ ਨਹੀਂ ਪਹੁੰਚਿਆ ਅਤੇ ਉਹ ਕਿੰਨੇ ਟਾਈਮ ਵਿੱਚ ਪਹੁੰਚੇਗਾ ਇਸ ਦੀ ਅਪਡੇਟ ਮੈਂ ਲੈਣਾ ਚਾਹੁੰਦੀ ਸੀ ਮੈਂ ਉਹ ਮੀਸ਼ੋ ਕੰਪਨੀ ਤੋਂ ਔਡਰ ਕੀਤਾ ਸੀ ਲੇਕਿਨ ਮੇਰਾ ਉਹ ਔਡਰ ਹਜੇ ਤੱਕ ਆਇਆ ਨਹੀਂ ਸੀ ਮੈਂ ਬਸ ਇਹ ਹੀ ਪੁੱਛਣਾ ਕਿ ਮੇਰਾ ਔਡਰ ਕਿੰਨੇ ਟਾਈਮ ਤੱਕ ਕਦੋਂ ਮੇਰੇ ਦਿੱਤੇ ਅਤੇ ਨਿਰਧਾਰਿਤ ਸਮੇਂ 'ਤੇ ਪਹੁੰਚੇਗਾ ਕਿਸ ਕਿਸ ਦੁਆਰਾ ਪਹੁੰਚਾਇਆ ਜਾ ਰਿਹਾ ਹੈ ਮੈਨੂੰ ਪੁੱਛ ਕੇ ਦੱਸਿਆ ਜਾਵੇ ਜੀ